ਹਾਂਜੀ ਸਕੂਲਾਂ ਵਿੱਚ ਵਧੇਰੇ ਕਿੱਤਾ ਮੁਖੀ ਸਿੱਖਿਆ ਹੋਣੀ ਚਾਹੀਦੀ ਹੈ ਜਿਵੇਂ ਤਰਖਾਣ ਪਲੰਬਿੰਗ ਸਿਲਾਈ ਪੋਲਟਰੀ ਅਤੇ ਪਸ਼ੂ ਪਾਲਣ ਸਿੱਖਿਆ ਦੇਣੀ ਚਾਹੀਦੀ ਹੈ ਕਿਉਂਕਿ ਇਸ ਦੇ ਨਾਲ ਜੋ ਹੈ ਬੱਚੇ ਆਪਣਾ ਆਪਣੇ ਆਪ ਨੂੰ ਅੱਗੇ ਜਾ ਕੇ ਇੰਨਡੀਪੈਨਡਸ ਰੱਖਦੇ ਹਨ ਜਿਹਦੇ ਨਾਲ ਕਿ ਬੱਚਿਆਂ ਨੂੰ ਮਤਲਬ ਇਹ ਉਹਨਾਂ ਕੋਲੋਂ ਇੱਕ ਤਾਂ ਮਤਲਬ ਇੱਕ ਇੱਕ ਤਜ਼ਰਬਾ ਰਹਿ ਜਾਂਦਾ ਹੈ ਕਿਸੇ ਵੀ ਕੰਮ ਨੂੰ ਕੀਤੇ ਕ ਕਰਨ ਦਾ ਜਾਂ ਕਿਸੇ ਵੀ ਕੰਮ ਨੂੰ ਕਰਨ ਦਾ ਉਹਨਾਂ ਕੋਲ ਇੱਕ ਇੱਕ ਐਕਸਪੀਰੀਅੰਸ ਰਹਿ ਜਾਂਦਾ ਹੈ ਜਿਸ ਦੇ ਨਾਲ ਉਹ ਅੱਗੇ ਜਾ ਕੇ ਇਹ ਨਹੀਂ ਸੋਚਦੇ ਕਿ ਇਹ ਚੀਜ਼ ਸਿੱਖਣੀ ਹੈ ਹੀ ਜਾਂ ਇਹ ਚੀਜ਼ ਅਸੀਂ ਕਰ ਨਹੀਂ ਸਕਦੇ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਚੀਜ਼ ਅਸੀਂ ਸਕੂਲ ਵਿੱਚ ਸਿੱਖੀ ਹੈ ਜਾਂ ਸਾਨੂੰ ਸਿਖਾਈ ਗਈ ਹੈ ਇਹ ਚੀਜ਼ ਅਸੀਂ ਪਹਿਲਾਂ ਕਰ ਚੁੱਕੇ ਹਾਂ ਇਸ ਚੀਜ਼ ਨੂੰ ਲੈ ਕੇ ਉਹ ਆਪਣੀ ਲਾਈਫ ਵਿੱਚ ਅੱਗੇ ਜਾ ਕੇ ਅਤੇ ਆਪਣੇ ਆਪ ਨੂੰ ਥੋੜ੍ਹਾ ਮਤਲਬ ਜਿਵੇਂ ਕਿ ਸ਼ਾਏ ਫੀਲ ਨਹੀਂ ਕਰਦੇ ਮਤਲਬ ਆਪਣੀ ਜੋ ਵੀ ਉਹਨਾਂ ਨੇ ਕੰਮ ਸਿੱਖਿਆ ਹੁੰਦਾ ਉਸਨੂੰ ਅੱਗੇ ਜਾ ਕੇ ਆਪਣੀ ਲਾਈਫ ਵਿੱਚ ਵਰਤਦੇ ਹਨ ਅਤੇ ਇਸ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸੌਖਾ ਹੋ ਜਾਂਦਾ ਹੈ ਇਸਦੇ ਨਾਲ ਹੀ ਜੋ ਕੰਮ ਸਿੱਖਿਆ ਹੁੰਦਾ ਹੈ ਉਹਨਾਂ ਕੋਲੋਂ ਉਹ ਉਹਨਾਂ ਨੂੰ ਅੱਗੇ ਜਾ ਕੇ ਕੋਈ ਵੀ ਪਰੇਸ਼ਾਨੀ ਨਹੀਂ ਦਿੰਦਾ ਉਹਨਾਂ ਦੇ ਕੰਮ ਹੀ ਆਉਂਦਾ ਹੈ